ਇਸ ਵਿੱਚ ਜਾਣਾ ਹੈ ਠੀਕ ਹੈ ਉਹਦੇ ਲਈ ਮੈਨੂੰ ਕੀ ਕਹਿੰਦੇ ਇੰਟਰਨੈਸ਼ਨਲ ਮੋਬਾਇਲ ਮਤਲਬ ਕਿ ਇੰਟਰਨੈਸ਼ਨਲ ਰੋਮਿੰਗ ਦੀ ਬਹੁਤ ਜ਼ਰੂਰਤ ਆ ਇਸ ਲਈ ਮੈਨੂੰ ਉਹਦੇ ਬਾਰੇ ਕੁਝ ਵੀ ਨਹੀਂ ਪਤਾ ਹੈਗਾ ਮੈਂ ਆਪਣੇ ਦੋਸਤ ਨਾਲ ਸੰਪਰਕ ਕੀਤਾ ਆ ਅਤੇ ਉਹਨੇ ਮੈਨੂੰ ਕਈ ਕੀ ਕੰਪਨੀਆਂ ਬਾਰੇ ਦੱਸਿਆ ਠੀਕ ਹੈ ਅਤੇ ਮੈਨੂੰ ਉਹਨਾਂ ਦੀ ਕੰਪਨੀਆਂ ਦੇ ਵਿੱਚ ਸਰਵਿਸ ਜਿਹੜੀ ਸੀਗੀ ਉਹ ਬਹੁਤ ਵਧੀਆ ਲੱਗੀ ਇਸ ਲਈ ਮੈਨੂੰ ਮਤਲਬ ਕਿ ਇੱਕ ਮਹੀਨੇ ਦਾ ਉਹਨਾਂ ਦਾ ਪੈਕ ਜਿਹੜਾ ਸੀਗਾ ਬਹੁਤ ਜ਼ਿਆਦਾ ਵਧੀਆ ਸੀਗਾ ਸੋ ਕੀ ਕਹਿੰਦੇ ਆ ਏਅਰਟੇਲ ਜਿੱਦਾਂ ਸੀਗੀ ਉਹਦੀ ਕੰਪਨੀ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੀ ਹੈ ਠੀਕ ਹੈ ਉਹਨਾਂ ਦਾ ਇੱਕ ਮਹੀਨੇ ਦਾ ਪੈਕ ਜਿਹੜਾ ਸੀਗਾ ਉਹ ਬਹੁਤ ਸਸਤਾ ਸੀਗਾ ਜੋ ਕਿ ਮੈਂ ਉਹ ਇੱਕ ਮਹੀਨੇ ਦਾ ਪੈਕ ਲਿੱਤਾ ਕਿਉਂਕਿ ਮੈਂ ਪੈਰਿਸ ਇੱਕ ਮਹੀਨੇ ਦਾ ਹੀ ਟੂਰ ਕੱਢਣਾ ਚਾਹੁੰਦੀ ਹਾਂ ਠੀਕ ਹੈ ਇਸ ਲਈ ਮੈਨੂੰ ਅੰਤਰਰਾਸ਼ਟਰੀ ਜਿਹੜੀਆਂ ਸੇਵਾਵਾਂ ਜਿਹੜੀ ਸੀਗੀ ਏਅਰਟੈੱਲ ਦੀ ਬਹੁਤ ਵਧੀਆ ਲੱਗੀ ਹੈ ਤੋ ਮੈਂ ਮੇਰਾ ਸਿਮ ਵੀ ਏਅਰਟੈੱਲ ਦਾ ਹੀ ਹੈ ਤੋ ਮੈਂ ਉਹਦੀ ਕੀ ਕਹਿੰਦੇ ਆ ਜੋ ਕੰਪਨੀ ਹੈ ਉਹ ਬਹੁਤ ਵਧੀਆ ਆ ਸੋ ਮੈਂ ਆਪਣੇ ਜਾਣਕਾਰੀਆਂ ਨੂੰ ਵੀ ਦੱਸਿਆ ਹੈ ਕਿ ਏਅਰਟੈੱਲ ਦਾ ਤੁਸੀਂ ਇੰਟਰਨੈਸ਼ਨਲ ਸਰਵਿਸ ਜਿਹੜੀ ਹੈ ਤੁਸੀਂ ਯੂਜ ਕਰ ਸਕਦੇ ਹੋ ਅਤੇ ਉਹਨਾਂ ਨੇ ਸਿਰਫ ਔਰ ਸਿਰਫ ਕੰਪਨੀ ਵਧੀਆ ਇੰਟਰਨੈਸ਼ਨਲ ਜੋ ਹੈਗਾ ਵਾ ਉਹਨਾਂ ਦਾ